ਸਾਡੇ ਸਮਾਜ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਹਨ ਪਰ ਮੈਂ ਅੱਜ ਤੁਹਾਨੂੰ ਆਪਣੇ ਸਿੱਖੀ ਧਰਮ ਦੇ ਵਿਆਹ ਬਾਰੇ ਜਾਣਕਾਰੀ ਦੱਸਦੀ ਹਾਂ ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਲੜਕੇ ਅਤੇ ਲੜਕੀ ਦਾ ਰੋਕਾ ਕੀਤਾ ਜਾਂਦਾ ਹੈ ਜਿਸ ਨੂੰ ਮੰਗਣੀ ਵੀ ਕਿਹਾ ਜਾਂਦਾ ਹੈ ਉਸ ਤੋਂ ਉਪਰੰਤ ਸਿਆਣੇ ਬੰਦੇ ਰਲ ਕੇ ਵਿਆਹ ਵਾਲਾ ਦਿਨ ਪੱਕਾ ਕਰਦੇ ਹਨ ਫਿਰ ਲੜਕੀ ਦੇ ਘਰ ਵੱਲ ਪਰਿਵਾਰ ਵੱਲੋਂ ਲੜਕੇ ਦੇ ਪਰਿਵਾਰ ਲਈ ਇੱਕ ਸਾਹਾ ਚਿੱਠੀ ਭੇਜੀ ਜਾਂਦੀ ਹੈ ਜਿਸ ਵਿੱਚ ਵਿਆਹ ਵਾਲਾ ਦਿਨ ਅਨੰਦ ਕਾਰਜ ਦਾ ਸਮਾਂ ਆਦਿ ਸਭ ਕੁਝ ਲਿਖਿਆ ਹੁੰਦਾ ਹੈ ਜਿਸ ਅਨੁਸਾਰ ਲੜਕਾ ਲੜਕੀ ਦੇ ਘਰ ਜੰਞ ਲੈ ਕੇ ਆਵੇਗਾ ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੇ ਅਤੇ ਲੜਕੀ ਦੇ ਬੰਨ ਲਾਇਆ ਜਾਂਦਾ ਹੈ ਜਿਸ ਨੂੰ ਹਲਦੀ ਲਾਉਣਾ ਵੀ ਆਖਿਆ ਜਾਂਦਾ ਹੈ ਉਸ ਤੋਂ ਉਪਰੰਤ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਖੁਸ਼ੀਆਂ ਮਨਾਉਂਦੇ ਹਨ ਭੰਗੜਾ ਪਾਉਂਦੇ ਹਨ ਅਤੇ ਦੂਜੇ ਦਿਨ ਲੜਕਾ ਤਿਆਰ ਹੋ ਕੇ ਜੰਞ ਲੈ ਕੇ ਲੜਕੀ ਦੇ ਘਰ ਜਾਂਦਾ ਹੈ ਜਿੱਥੇ ਸਿੱਖ ਧਰਮ ਦੇ ਅਨੁਸਾਰ ਗੁਰੂ ਘਰ ਵਿੱਚ ਲਾਵਾਂ ਦੀ ਰਸਮ ਹੁੰਦੀ ਹੈ ਉਸ ਤੋਂ ਉਪਰੰਤ ਲੜਕਾ ਡੋਲੇ ਲੈ ਕੇ ਆਪਣੇ ਘਰ ਨੂੰ ਰਵਾਨਾ ਹੁੰਦਾ ਹੈ ਜਿੱਥੇ ਉਸਦੀ ਮਾਂ ਬੜੀ ਬੇਸਬਰੀ ਦੇ ਨਾਲ਼ ਇੰਤਜ਼ਾਰ ਕਰਦੀ ਹੁੰਦੀ ਹੈ ਲੜਕੇ ਦੇ ਡੋਲਾ ਲੈ ਕੇ ਪਹੁੰਚਣ ਤੋਂ ਉਪਰੰਤ ਮਾਂ ਆਪਣੇ ਬੱਚਿਆਂ ਨੂੰ ਲਾੜਾ ਅਤੇ ਲਾੜੀ ਨੂੰ ਰੰਗਲੀ ਚੌਂਕੀ 'ਤੇ ਚੜ੍ਹਾਅ ਕੇ ਪਾਣੀ ਵਾਰਨ ਦੀ ਰਸਮ ਅਦਾ ਕਰਦੀ ਹੈ ਅਤੇ ਬੜੀਆਂ ਸੁੱਖਾਂ ਸੁੱਖ ਕੇ ਲਾੜੀ ਨੂੰ ਆਪਣੇ ਘਰ ਗ੍ਰਹਿ ਪ੍ਰਵੇਸ਼ ਕਰਦੀ ਹੈ ਜਿਸ ਦੇ ਨਾਲ਼ ਹੀ ਵਿਆਹ ਦੀ ਰਸਮ ਸੰਪੂਰਨ ਹੁੰਦੀ ਹੈ